ਮੈਨੂੰ ਚਿੱਤਰਕਾਰੀ ਬਹੁਤ ਪਸੰਦ ਹੈ ਪਰ ਮੈਨੂੰ ਚਿੱਤਰਕਾਰੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਮੈਂ ਬਾਜ਼ਾਰ ਵਿੱਚ ਬਹੁਤ ਸਾਰੀਆਂ ਪੇਂਟਿੰਗ ਚਿੱਤਰਕਾਰੀ ਦੇਖੀਆਂ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਚਿੱਤਰਕਾਰੀ ਬਾ ਚਿੱਤਰਕਾਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪ ਚਿੱਤਰਕਾਰੀ ਕਰਨੀ ਸ਼ੁਰੂ ਕੀਤੀ ਦੂਸਰਾ ਮੈਂ ਆਪਣੇ ਫਰੈਂਡ ਸਰਕਲ ਵਿੱਚ ਵੀ ਚਿੱਤਰਕਾਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਮੇਰੀ ਇੱਕ ਫਰੈਂਡ ਜਿਸਨੇ ਆਟ ਐਂਡ ਕ੍ਰਾਫਟ ਦਾ ਕੋਰਸ ਕੀਤਾ ਸੀ ਉਸਨੇ ਮੈਨੂੰ ਚਿੱਤਰਕਾਰੀ ਬਾਰੇ ਜਾਣਕਾਰੀ ਦਿੱਤੀ ਉਹ ਬਹੁਤ ਸਾਰੀਆ ਸੋਹਣੀਆਂ ਚਿੱਤਰਕਾਰੀ ਪੇਂਟਿੰਗ ਸੂਟਾਂ 'ਤੇ ਪੇਂਟ ਕਰਦੀ ਸੀ ਜਿਸ ਬਾਰੇ ਉਹਨੇ ਮੈਨੂੰ ਜਾਣਕਾਰੀ ਦਿੱਤੀ ਅਤੇ ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਆਪ ਚਿੱਤਰਕਾਰੀ ਕਰਨੀ ਸ਼ੁਰੂ ਕੀਤੀ ਸੂਟਾਂ 'ਤੇ ਪੇਂਟਿੰਗ ਸ਼ੁਰੂ ਕੀਤੀ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ